ਹਾਂਜੀ ਭੰਗੜਾ ਸਿਰਫ ਪੰਜਾਬ ਵਿੱਚ ਹੀ ਪ੍ਰਚਲਿਤ ਨਹੀਂ ਦੁਨੀਆ ਭਰ ਵਿੱਚ ਹੀ ਪ੍ਰਚਲਿਤ ਹੈ ਕਿਉਂਕਿ ਪੰਜਾਬ ਦੇ ਵਿੱਚ ਸਿਰਫ ਇਸ ਤੋਂ ਬਿਨਾ ਕੋਈ ਤਿਉਹਾਰ ਨਹੀਂ ਮਨਾਇਆ ਜਾਂਦਾ ਇਸ ਤੋਂ ਬਿਨਾ ਤਿਉਹਾਰ ਸਾਰੇ ਹੀ ਫਿੱਕੇ ਲੱਗਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਭੰਗੜਾ ਜ਼ਰੂਰ ਹੀ ਪਾਇਆ ਜਾਂਦਾ ਹੈ ਚਾਹੇ ਉਹ ਲੋਹੜੀ ਹੋਵੇ ਚਾਹੇ ਬੱਚੇ ਜੰਮਣ ਦੀ ਖੁਸ਼ੀ ਵਿੱਚ ਹੀ ਮਨਾਇਆ ਜਾਵੇ ਤਾਂ ਭੰਗੜਾ ਪਾਉਣਾ ਜ਼ਰੂਰੀ ਹੈ ਇਸ ਤੋਂ ਇਸ ਤੋਂ ਬਿਨਾ ਪੰਜਾਬ ਦੇ ਵਿੱਚ ਕੋਈ ਵੀ ਤਿਉਹਾਰ ਨਹੀਂ ਮਨਾਇਆ ਜਾਂਦਾ ਅੱਜ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਭੰਗੜਾ ਪਾਇਆ ਜਾਂਦਾ ਹੈ ਸਾਡਾ ਦਿਲ ਪਰਚਾਉਣ ਵਾਲਾ ਕਲਾਕਾਰ ਦਿਲਜੀਤ ਸੁੰ ਦੋਸਾਂਝ ਭੰਗੜੇ ਨੂੰ ਵਿਦੇਸ਼ਾਂ ਵਿੱਚ ਵੀ ਲੈ ਕੇ ਗਿਆ ਹੈ ਜੋ ਕਿ ਉਹਨਾਂ ਲਈ ਵੀ ਅੱਜ ਕੱਲ੍ਹ ਕੋਈ ਵੀ ਤਿਉਹਾਰ ਬਿਨਾ ਭੰਗੜੇ ਤੋਂ ਨਹੀਂ ਮਨਾਇਆ ਜਾਂਦਾ ਭੰਗੜਾ ਸਿਰਫ ਦੁਨੀਆ ਭਰ ਵਿੱਚ ਹੀ ਪ੍ਰਚਲਿਤ ਨਹੀਂ ਪੂਰੇ ਵਿਦੇਸ਼ਾਂ ਵਿੱਚ ਪੂਰੇ ਭਾਰਤ ਵਿੱਚ ਵੀ ਪ੍ਰਚਲਿਤ ਹੈ ਭੰਗੜੇ ਤੋਂ ਬਿਨਾ ਕੋਈ ਵੀ ਤਿਉਹਾਰ ਨਹੀਂ ਮਨਾਇਆ ਜਾਂਦਾ ਹੈ ਇਹ ਸਿਰਫ ਪੰਜਾਬ ਵਿੱਚ ਹੀ ਨਹੀਂ ਸਾਰੇ ਦੇਸ਼ਾਂ ਵਿੱਚ ਵੀ ਅੱਜ ਕੱਲ੍ਹ ਪਾਇਆ ਜਾਂਦਾ ਹੈ ਭੰਗੜੇ ਤੋਂ ਬਿਨਾ ਕੋਈ ਵੀ ਤਿਉਹਾਰ ਮਨਾਇਆ ਨਹੀਂ ਜਾਂਦਾ ਭੰਗੜਾ ਸਾਡੀ ਇੱਕ ਪ੍ਰਚਲਿਤ ਡਾਂਸ ਕਹਿ ਲਓ ਚਾਹੇ ਲੋਕ ਨਾਚ ਕਹਿ ਲਓ ਜੋ ਕਿ ਬਹੁਤ ਪ੍ਰਸਿੱਧ ਹੈ ਪੰਜਾਬ ਦੇ ਅੰਦਰ ਇਸ ਤੋਂ ਬਿਨਾ ਕੋਈ ਵੀ ਵਿਆਹ ਸ਼ਾਦੀ ਨਹੀਂ ਮਨਾਇਆ ਜਾਂਦਾ ਜੇ ਕੋਈ ਇਸ ਤੋਂ ਬਿਨਾ ਵਿਆਹ ਸ਼ਾਦੀ ਲਈ ਕਰਦਾ ਹੈ ਤਾਂ ਉਹ ਸਿਰਫ ਫਿੱਕੀ ਫਿੱਕੀ ਜਿਹੀ ਲੱਗਦੀ ਆ ਇਸ ਲਈ ਭੰਗੜਾ ਸਿਰਫ ਪੰਜਾਬ ਵਿੱਚ ਹੀ ਪ੍ਰਚਲਿਤ ਨਹੀਂ ਦੁਨੀਆ ਭਰ ਵਿੱਚ ਹੀ ਮਨਾਇਆ ਜਾਂਦਾ ਹੈ ਇਹ ਕੋਈ ਤਿਉਹਾਰ ਨਹੀਂ ਹੈ ਪਰ ਇੱਕ ਲੋਕ ਨਾਚ ਹੈ ਜੋ ਕਿ ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ ਠੀਕ ਹੈ ਇਸ ਤੋਂ ਬਗੈਰ ਕੋਈ ਵੀ ਤਿਉਹਾਰ ਨਹੀਂ ਮਨਾਇਆ ਜਾਂਦਾ ਹੈ